ਬਾਗਬਾਨੀ ਕਰਨ ਵਿੱਚ ਮੇਰੀ ਸ਼ੁਰੂ ਤੋਂ ਦਿਲਚਸਪੀ ਰਹੀ ਹੈ ਬਾਗਬਾਨੀ ਸ਼ੁਰੂ ਕਰਨ ਲਈ ਮੈਨੂੰ ਜਿਸ ਚੀਜ਼ ਨੇ ਪ੍ਰੇਰਿਤ ਕੀਤਾ ਉਹ ਹੈ ਮੇਰੇ ਮਾਸੀ ਜੀ ਜੋ ਕਿ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਉਹਨਾਂ ਦਾ ਪੌਦਿਆਂ ਅਤੇ ਵਾਤਾਵਰਨ ਵਿੱਚ ਬਹੁਤ ਹੀ ਜ਼ਿਆਦਾ ਰੁਝਾਨ ਰਿਹਾ ਹੈ ਉਹ ਹਮੇਸ਼ਾ ਤੋਂ ਉਹਨਾਂ ਨੂੰ ਇਸ ਚੀਜ਼ 'ਤੇ ਬਹੁਤ ਚੰਗਾ ਲੱਗਦਾ ਹੈ ਉਹ ਮੈਂ ਦੇਖਦਾ ਆ ਰਿਹਾ ਕਿ ਉਹ ਬਹੁਤ ਚਿਰ ਤੋਂ ਆਪਣੇ ਘਰ ਵਿੱਚ ਵੀ ਬਹੁਤ ਸਾਰੇ ਪੌਦੇ ਲਗਾਉਂਦੇ ਹਨ ਵਾਤਾਵਰਨ ਨੂੰ ਬਚਾਉਣ ਲਈ ਉਹ ਹਮੇਸ਼ਾ ਅੱਗੇ ਰਹਿੰਦੇ ਹਨ ਮੇਰੇ ਮਿੱਤਰ ਵੀ ਇਹੋ ਇਸ ਤਰ੍ਹਾਂ ਦੇ ਕੰਮ ਬਹੁਤ ਕਰਦੇ ਹਨ ਉਹਨਾਂ ਨੇ ਵੀ ਆਪਣੇ ਗਾਰਡਨ ਦੇ ਵਿੱਚ ਬੂਟੇ ਲਗਾਏ ਹੋਏ ਹਨ ਉਹਨਾਂ ਵੱਲ ਦੇਖ ਕੇ ਵੀ ਮੈਂ ਪ੍ਰੇਰਿਤ ਹੁੰਦਾ ਹਾਂ ਕਿ ਜੇ ਉਹ ਲਗਾ ਸਕਦੇ ਹਨ ਅਤੇ ਮੈਂ ਵੀ ਲਗਾ ਸਕਦਾ ਹਾਂ ਮੇਰੇ ਅਧਿਆਪਕ ਵੀ ਮੈਨੂੰ ਬਹੁਤ ਮਦਦ ਕਰਦੇ ਹਨ ਬੂਟੇ ਲਗਾਉਣ ਵਿੱਚ ਸਾਡੇ ਸਕੂਲ ਵੱਲੋਂ ਸਾਨੂੰ ਫੰਡ ਵੀ ਕਰਕੇ ਦਿੱਤੇ ਜਾਂਦੇ ਹਨ ਧੰਨਵਾਦ